ਵੈਸੇ ਤਾਂ ਮੈਨੂੰ ਜ਼ਿਆਦਾ ਨਹੀਂ ਪਤਾ ਕਿ ਨਗਰ ਪਾਲਿਕਾ ਜਾਂ ਪੰਚਾਇਤ ਕੀ ਕਰਦੀ ਹੈ ਕਿਉਂਕਿ ਮੈਂ ਕਦੇ ਐਨਾ ਗੌਰ ਨਹੀਂ ਕੀਤਾ ਇਹਨਾਂ ਚੀਜ਼ਾਂ 'ਤੇ ਲੇਕਿਨ ਮੋਟਾ ਮੋਟਾ ਹੀ ਸਾਫ ਜਿੱਥੋਂ ਤੱਕ ਮੈਨੂੰ ਪਤਾ ਕਿ ਪੰਚਾਇਤ ਦਾ ਕੰਮ ਆਪਣੇ ਪਿੰਡ ਦੇ ਮਸਲੇ ਸੁਲਝਾਉਣ 'ਚ ਜਾਂ ਪਿੰਡ ਦੀ ਜੋ ਕਿ ਡਿਵਲਪਮੈਂਟ ਵਿੱਚ ਕੰਮ ਡਿਵਲਪਮੈਂਟ ਕਰਨ ਵਿੱਚ ਕਾਫੀ ਮਤਲਬ ਯੋਗਦਾਨ ਰਹਿੰਦਾ ਹੈ ਪੰਜਾ ਅਤੇ ਬਾਕੀ ਸਕੂਲ ਅਤੇ ਜਿਹੜੇ ਸਰਕਾਰੀ ਸਕੂਲ ਹੁੰਦੇ ਆ ਪਿੰਡਾਂ ਵਿੱਚ ਅਤੇ ਬਾਕੀ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇ ਉਹਨਾਂ ਵਿੱਚ ਕਾਫੀ ਮਤਲਬ ਲੋੜਵੰਦ ਚੀਜ਼ਾਂ ਦੀ ਜ਼ਰੂਰਤ ਪੂਰੀਆਂ ਕਰਦੇ ਨੇ ਪਿੰਡ ਵਿੱਚ ਕੋਈ ਵੀ ਚੀਜ਼ ਨਵੀਂ ਖੋਲ੍ਹਣੀ ਜਿੱਦਾਂ ਜਿਮ ਖੋਲ੍ਹਣੀ ਹੋਏਗੀ ਜਾਂ ਕੋਈ ਹੋਰ ਚੀਜ਼ ਜਿੱਦਾਂ ਗਰਾਊਂਡ ਬਣਨੇ ਆ ਜਾਂ ਪਾਰਕ ਬਣਨੇ ਆ ਉਹ ਸਾਰੀਆਂ ਚੀਜ਼ਾਂ ਨੂੰ ਪੂਰਾ ਪੰਚ ਪਿੰਡ ਦੀ ਪੰਚਾਇਤ ਦੀਆਂ ਨਗਰ ਪਾਲਿਕਾ ਕਰਦੀ ਹੈ ਅਤੇ ਸਾਫ ਸਫਾਈ ਅਤੇ ਦੂਜਾ ਹੈਲਥ ਹੈਲਥ ਸੈਕਟਰ ਦਾ ਨਹੀਂ ਮੈਨੂੰ ਜ਼ਿਆਦਾ ਪਤਾ ਲੇਕਿਨ ਸਾਫ ਸਫਾਈ ਪਿੰਡ ਦੀ ਅਤੇ ਸ਼ਹਿਰਾਂ ਦੀ ਨਗਰ ਪਾਲਿਕਾ ਅਤੇ ਪੰਚਾਇਤ ਹੀ ਵੇਖਦੀਆਂ ਨੇ